ਇਸ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਇਹ ਤਿਉਹਾਰ ਵਿਸਾਖੀ ਵਾਲੇ ਦਿਨਾਂ ਵਿੱਚ ਮਨਾਇਆ ਜਾਂਦਾ ਹੈ ਇੱਥੇ ਨਿਹੰਗ ਫੌਜਾਂ ਆ ਕੇ ਹੋਲੀ ਖੇਡਦੀਆਂ ਹਨ ਜਿੰਨਾ ਆਪਣੇ ਆਪ ਨੂੰ ਰੰਗਦੀਆਂ ਹਨ ਅਤੇ ਗੁਰੂ ਦੇ ਰੰਗ ਵਿੱਚ ਰੰਗ ਜਾਂਦੇ ਆ ਅਤੇ ਦੂਸਰਾ ਸਥਾਨ ਹੈਗਾ ਭਾਰਤ ਵਿੱਚ ਵਰਿੰਦਾਵਨ ਵਰਿੰਦਾਵਨ ਦੀ ਹੋਲੀ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਇਹ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਜਨਮ ਸਥਾਨ 'ਤੇ ਜੋ ਹੋਲੀ ਮਨਾਈ ਜਾਂਦੀ ਹੈ ਇਹ ਹੋਲੀ ਕਈ ਦਿਨ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਇੱਥੇ ਵੱਖ ਵੱਖ ਤਰ੍ਹਾਂ ਦੀ ਹੋਲੀ ਬਣਾਈ ਜਾਂਦੀ ਹੈ ਅਤੇ ਤੀਸਰਾ ਸਥਾਨ ਸ਼੍ਰੀ ਮੁਕਤਸਰ ਸਾਹਿਬ ਹੈ ਜਿੱਥੇ ਚਾਲੀ ਮੁਕਤਿਆ ਇਹਨੂੰ ਚਾਲੀ ਮੁਕਤਿਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ ਮਾਘੀ ਵਾਲੇ ਦਿਨ ਇੱਥੇ ਬਹੁਤ ਵੱਡਾ ਮੇਲਾ ਲੱਗਦਾ ਹੈ ਜੋ ਕਿ ਮਹੀਨਾ ਚੱਲਦਾ ਹੈ ਇੱਥੇ ਅਤੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਪੂਰੇ ਮਹੀਨੇ ਵਿੱਚ ਸੰਗਤਾਂ ਗੁਰਦੁਆਰੇ ਆ ਕੇ ਮੱਥਾ ਟੇਕਦੀਆਂ ਹਨ ਮਾਘੀ ਵਾਲੇ ਦਿਨ ਇਸ਼ਨਾਨ ਕਰਦੀਆਂ ਨੇ ਜੋ ਕਿ ਲੋਹੜੀ ਤੋਂ ਇੱਕ ਦਿਨ ਬਾਅਦ ਹੀ ਲੱਗ ਜਾਂਦਾ ਹੈ ਅਤੇ ਚੌਥਾ ਸਥਾਨ ਹੈਗਾ ਮਾਤਾ ਵੈਸ਼ਨੂੰ ਮਾਤਾ ਵੈਸ਼ਨੋ ਦੇਵੀ ਵਿੱਚ ਨਰਾਤਿਆਂ ਦੇ ਦਿਨ ਬਹੁਤ ਹੀ ਜ਼ਿਆਦਾ ਮਾਨਤਾ ਮੰਨੀ ਜਾਂਦੀ ਹੈ ਕਿਉਂਕਿ ਨਾਰਾਤੇ ਨੌਂ ਦਿਨਾਂ ਦੇ ਹੁੰਦੇ ਹਨ ਜੋ ਕਿ ਮਾਤਾ ਦੇ ਨੌਂ ਰੂਪਾਂ ਨੂੰ ਦਰਸਾਉਂਦੇ ਹਨ ਇੱਥੇ ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਨੌਂ ਦਿਨ ਬਹੁਤ ਹੀ ਧਾਰਮਿਕ ਪਰੰਪਰਾਵਾਂ ਨਾਲ ਇਸ ਨੂੰ ਮਨਾਇਆ ਜਾਂਦਾ ਹੈ ਅਤੇ ਪੰਜਵਾਂ ਅਤੇ ਮਹੱਤਵਪੂਰਨ ਸਥਾਨ ਹੈ ਹਰਿਦੁਆਰ ਜੋ ਕਿ ਹਿੰਦੂਆਂ ਦਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸਥਾਨ ਹੈ ਇੱਥੇ ਹਿੰਦੂਆਂ ਦੀਆਂ ਅਸਥੀਆਂ ਜੋ ਕਿ ਮਰਨ ਤੋਂ ਬਾਅਦ ਇੱਥੇ ਪਾਈਆਂ ਜਾ ਵਹਾਈਆਂ ਜਾਂਦੀਆਂ ਹਨ ਅਤੇ ਉਹਨਾਂ ਦਾ ਪਿੰਡ ਦਾਨ ਵੀ ਕੀਤਾ ਜਾਂਦਾ ਹੈ